ਵਿਆਹਾਂ ਵਿੱਚ ਕਾਫੀ ਤਰੀਕੇ ਹਨ ਜਿਸ ਦਾ ਆਨੰਦ ਮਾਨਿਆ ਜਾ ਸਕਦਾ ਹੈ ਸਭ ਤੋਂ ਪਹਿਲੇ ਤਾਂ ਵਿਆਹਾਂ ਦੇ ਵਿਚ ਰਿਸ਼ਤੇਦਾਰਾਂ ਨੂੰ ਦੂਰ ਦੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਬਹੁਤ ਹੀ ਘੱਟ ਮਿਲਿਆ ਜਾਂਦਾ ਹੈ ਆਮ ਤੌਰ 'ਤੇ ਉਹ ਸਾਰੇ ਵਿਆਹ ਵਿੱਚ ਇਕੱਠੇ ਹੁੰਦੇ ਹਨ ਅਤੇ ਹੱਸਦੇ ਗਾਉਂਦੇ ਹਨ ਨੱਚ ਟੱਪ ਕੇ ਕੁੜੀਆਂ ਇੱਕ ਦੂਜੇ ਨਾਲ ਹਸੀ ਮਜ਼ਾਕ ਕਰਦੀਆਂ ਹਨ ਕਲੋਲਾਂ ਕਰਦੀਆਂ ਹਨ ਔਰ ਖਾ ਪੀ ਕੇ ਵਿਆਹਾਂ ਦੇ ਵਿੱਚ ਵੰਨ ਸੁਵੰਨੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਨੂੰ ਉਹ ਲੋਕ ਬੜੇ ਹੀ ਖੁਸ਼ ਹੋ ਕੇ ਅਤੇ ਬੜੇ ਹੀ ਚਾਅ ਨਾਲ ਖਾਂਦੇ ਹਨ ਹੋਰ ਵੀ ਕਾਫੀ ਟਾ ਅ ਤਰੀਕੇ ਹਨ ਜਿ ਵਿਆਹਾਂ ਦੇ ਵਿੱਚ ਜਿਹੜੇ ਛੋਟੇ ਮੋਟੀਆਂ ਰਸਮ ਰਿਵਾਜਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਛੋ ਹਾਸੇ ਠਠੋਲੇ ਪੈਂਦੇ ਹਨ ਉਹਨਾਂ ਦੇ ਵਿੱਚ ਹਿੱਸਾ ਲੈ ਕੇ ਜਾਂ ਉਹਨਾਂ ਰਸਮਾਂ ਨੂੰ ਦੇਖ ਕੇ ਇਹ ਲੋਕ ਬਹੁਤ ਖੁਸ਼ ਹੁੰਦੇ ਹਨ ਆਨੰਦ ਮਾਣਦੇ ਹਨ ਦੁਲ੍ਹਾ ਦੁਲਹਨ ਨੂੰ ਇੱਕ ਦੂਜੇ ਨਾਲ ਹਸੀ ਮਜ਼ਾਕ ਕਰਦੇ ਹੋਏ ਉਹਨਾਂ ਨੂੰ ਇੱਕ ਦੂਜੇ ਵੱ ਇੱਕ ਦੂਜੇ ਨਾਲ ਉਹ ਇੱਕ ਦੂਜੇ ਵੱਲ ਦੇਖ ਕੇ ਸ਼ਰਮਾਉਂਦੇ ਹੋਏ ਉਹ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਆ ਆਨੰਦ ਮਾਣਦੇ ਹਨ ਹੋਰ ਵੀ ਵਿਆਹਾਂ ਦੇ ਵਿੱਚ ਕਈ ਗਾਣੇ ਹਨ ਜਿਨ੍ਹਾਂ 'ਤੇ ਡਾਂਸ ਕਰਕੇ ਲੋਕਾਂ ਨੂੰ ਵਧੀਆ ਲੱਗਦਾ ਹੈ ਜਿਵੇਂ ਲੇਡੀ ਸੰਗੀਤ ਦੇ ਗਾਣੇ ਜਿਵੇਂ ਡਿਸਕੋ ਦੀਵਾਨੇ ਔ ਔਰ ਪੰਜਾਬੀ ਕਲਚਰ ਸੌਂਗ ਜਿਹੜੇ ਪੁਰਾਣੇ ਗੀਤ ਭੰਗੜੇ ਅਤੇ ਗਿੱਧੇ ਨੂੰ ਦਰਸਾਉਂਦੇ ਹਨ ਉਹਨਾਂ ਉੱਤੇ ਡਾਂਸ ਕਰਕੇ ਕਾਫੀ ਵਧੀਆ ਲੱਗਦਾ ਹੈ ਹੋਰ ਵੀ ਕਈ ਗਾਣੇ ਹਨ ਜਿਨ੍ਹਾਂ 'ਚ ਲੋਕ ਲੋਕ ਡਾਂਸ ਕਰਨਾ ਪਸੰਦ ਕਰਦੇ ਹਨ ਇਹ ਜ਼ਿਆਦਾਤਰ ਜੋ ਹੁੰਦੇ ਹਨ ਜਿਹੜੇ ਡਿਸਕੋ ਵਾਲੇ ਸੌਂਗ ਹੁੰਦੇ ਹਨ ਜਿਹਨਾਂ 'ਤੇ ਡੀ ਜੇ ਦੀ ਬੀਟ ਵੱਜਦੀ ਹੈ ਲੋਕ ਇਸਦੇ ਕਾਫੀ ਜ਼ਿਆਦਾ ਨੱਚਣਾ ਪਸੰਦ ਕਰਦੇ ਹਨ ਔਰ ਪੰਜਾਬੀ ਕਲਚਰ ਸੌਂਗ ਹੁੰਦੇ ਹਨ ਜਿਹੜੇ ਉਹਨਾਂ 'ਤੇ ਨੱਚਣਾ ਪਸੰਦ ਕਰਦੇ ਹਨ ਕੁਛ ਸੈਡ ਸੌਂਗਜ਼ ਲੱਗਦੇ ਹਨ ਕਿਉਂਕਿ ਦੁਲਹਣ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਸੋਹਰਿਆਂ ਦੇ ਘਰ ਜਾਣਾ ਚਾਹੁੰਦੀ ਹੈ ਜਿਸ ਕਰਕੇ ਥੋੜ੍ਹਾ ਦੁਖੀ ਵਾਲੇ ਦੁਖੀ ਹੋਣ ਲਈ ਥੋੜ੍ਹੇ ਸੈਡ ਸੌਂਗ ਲਗਾਉਂਦੇ ਹਨ ਵਿਦਾਈ ਦੇ ਸਮੇਂ ਹੋਰ ਵੀ ਕਈ ਤਰ੍ਹਾਂ ਦੇ ਗਾਣੇ ਹਨ ਜਿਨ੍ਹਾਂ 'ਤੇ ਅ ਲੋਕ ਨੱਚਣਾ ਪਸੰਦ ਕਰਦੇ ਹਨ ਅੱਜ ਕੱਲ੍ਹ ਦੇ ਵਿਆਹਾਂ ਦੇ ਵਿੱਚ ਘਰ ਦੇ ਹਰ ਇੱਕ ਮੈਂਬਰ ਦੀ ਆਪਣੀ ਆਪਣੀ ਪਰਫਾਰਮੈਂਸ ਹੁੰਦੀ ਹੈ ਜਿਵੇਂ ਮੁੰਡੇ ਕੁੜੀ ਦੀ ਭੈਣ ਆਪਣੀ ਭੈਣ ਵਾਸਤੇ ਪਰਫੋਰਮੈਂਸ ਕਰਦੀ ਹੈ ਨੱਚਦੀ ਹੈ ਗਾਉਂਦੀ ਹੈ ਠੀਕ ਹੈ ਕੁੜੀ ਦੇ ਮਾਪੇ ਆਪਣੇ ਧੀ ਲਈ ਪਰਫੋਰਮੈਂਸ ਕਰਦੇ ਆ ਨੱਚਦੇ ਟੱਪਦੇ ਗਾਉਂਦੇ ਹਨ ਸਾਰੇ ਹੱਸੀ ਖੁਸ਼ੀ ਨਾਲ ਆਪਣੇ ਮੁੰਡੇ ਦਾ ਅਤੇ ਅਤੇ ਆਪਣੀ ਧੀ ਦਾ ਵਿਆਹ ਕਰਦੇ ਹਨ ਜਿਸ ਨਾਲ ਹ ਬਾਕੀ ਰਿਸ਼ਤੇਦਾਰਾਂ ਨੂੰ ਬਹੁਤ ਹੀ ਖੁਸ਼ੀ ਅਤੇ ਆਨੰਦ ਪ੍ਰਾਪਤ ਹੁੰਦਾ ਹੈ ਔਰ ਕਈ ਜਿਹੜੇ ਦੂਰ ਦੁਰਾਡੇ ਦੇ ਰਿਸ਼ਤੇਦਾਰ ਕਦੀ ਨਾ ਮਿਲਣ ਆਉਣ ਕਦੇ ਨਾ ਮਿਲਣ ਬਹੁਤ ਦੂਰ ਰਹਿੰਦੇ ਹੋਣ ਜਿਨ ਆਮ ਤੌਰ 'ਤੇ ਨਾ ਮਿਲਿਆ ਜਾ ਸਕੇ ਉਹ ਵਿਆਹ 'ਤੇ ਇਕੱਠੇ ਹੋ ਕੇ ਇੱਕ ਦੂਸਰੇ ਦੀਆ ਬਚਪਨ ਦੀਆਂ ਕਹਾਣੀਆਂ ਦੱਸਦੇ ਹਨ ਬਚਪਨ ਦੇ ਕਿੱਸੇ ਦੱਸਦੇ ਹਨ ਉਸ ਨਾਲ ਵੀ ਬਹੁਤ ਖੁਸ਼ੀ ਮਿਲਦੀ ਹੈ ਧੰਨਵਾਦ